ਮੈਂ ਕ੍ਰਿਕਟ ਖੇਲਦਾ ਹਾਂ ਮੈਂ ਕ੍ਰਿਕਟ ਦਾ ਬਹੁਤ ਵੱਡਾ ਖਿਲਾਰੀ ਹਾਂ ਅਤੇ ਸਾਡੇ ਪਿੰਡ ਦੇ ਪੰਚਾਇਤ ਮੈਂਬਰ ਨੇ ਸਾਨੂੰ ਬਹੁਤ ਵੱਡਾ ਗਰਾਉਂਡ ਬਣਵਾ ਕੇ ਦਿੱਤਾ ਹੈ ਅਤੇ ਉਨਾਂ ਨੇ ਬਹੁਤ ਸਾਰੀਆਂ ਸਹੂਲਤਾਂ ਕੱਢੀਆਂ ਹਨ ਜਿਵੇਂ ਕਿ ਅਸੀਂ ਸਾਰੇ ਪਿੰਡ ਦੇ ਵਿਦਿਆਰਥੀ ਅਸੀਂ ਪਿੰਡ ਦੇ ਪਿੰਡ ਦੇ ਮਿੱਤਰ ਦੋਸਤ ਆਦਿ ਸਾਰੇ ਹੀ ਸਵੇਰੇ ਉੱਠ ਕੇ ਰਨਿੰਗ ਕਰਕੇ ਅਤੇ ਉਸ ਤੋਂ ਬਾਅਦ ਅਸੀਂ ਖੇਲਣ ਲੱਗ ਪੈਂਦੇ ਹਾਂ ਅਤੇ ਮੈਂ ਬਹੁਤ ਮੈਂ ਬਹੁਤ ਸਾਰੀਆਂ ਗੇਮ ਮੈਂ ਬਹੁਤ ਜਗ੍ਹਾ 'ਤੇ ਖੇਲਣ ਗਿਆ ਹੋਇਆ ਹਾਂ ਅਤੇ ਮੈਂ ਬਹੁਤ ਸਾਰ ਮੈਂ ਬਹੁਤ ਜਗ੍ਹਾ 'ਤੇ ਜਿੱਤਿਆ ਵੀ ਹਾਂ ਅਤੇ ਮੈਨੂੰ ਆਦਿ ਟਰੋਫੀ ਮੈਡਲ ਬਹੁਤ ਮਿਲੇ ਮਿਲੇ ਹੋਏ ਹਨ ਸਾਨੂੰ ਬਹੁਤ ਇਨਾਮ ਵੀ ਮਿਲੇ ਹਨ ਸਾਡੇ ਪਿੰਡ ਵਾਲ਼ਿਆਂ ਨੇ ਸਾਡੇ ਸਾਡੇ ਲਈ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਹੀ ਵਧੀਆ ਗਰਾਊਂਡ ਬਣਵਾਇਆ ਹੋਇਆ ਹੈ ਅਸੀਂ ਉੱਥੇ ਜਾ ਕੇ ਅਸੀਂ ਉੱਥੇ ਜਾ ਕੇ ਹੀ ਆਪਣੀ ਪ੍ਰੈਕਟਿਸ ਕਰਦੇ ਹਾਂ